ਮੇਲਿਆਂ ਦੀ ਪੰਜਾਬ ਵਿੱਚ ਮੇਲਿਆਂ ਦੀ ਮਹੱਤਤਾ ਦੱਸੋ ਤੁਸੀਂ ਮੇਲੇ ਕਦੋਂ ਗਏ ਸੀ ਅਤੇ ਇਹ ਤਜ਼ਰਬਾ ਕਦੋਂ ਦਾ ਸੀ ਮੈਂ ਮੇਲੇ ਦੇ ਵਿੱਚ ਲੋਹੜੀ ਵਾਲੇ ਦਿਨ ਮੁਕਤਸਰ ਸਾਹਿਬ ਗਿਆ ਸੀ ਇਸ ਦੀ ਮਹੱਤਤਾ ਸਾਡਾ ਆਪਸ ਦੇ ਵਿੱਚ ਭਾਈਚਾਰਾ ਔਰ ਗੁਰੂਆਂ ਦੀ ਮੰਨੀ ਧਰਤੀ ਅਤੇ ਇਸਨਾਨ ਕਰਨ ਦਾ ਤਜਰਬਾ ਅਸੀਂ ਸਾਰੇ ਰਲ ਮਿਲ ਕੇ ਮੇਲਿਆਂ 'ਚ ਮੌਜ ਮਸਤੀਆਂ ਮਾਰਦੇ ਹਾਂ ਸਾਡੇ ਵੇਲੇ ਦਾ ਤਾਂ ਮੇਲਾ ਸੀ ਜੋ ਉਹ ਬਹੁਤ ਖੁਸ਼ਗਵਾਰ ਅਤੇ ਵਧੀਆ ਮੇਲਾ ਹੁੰਦਾ ਸੀ ਅਸੀਂ ਇੱਕ ਦੂਜੇ ਨਾਲ ਮਿਲ ਕੇ ਖਾਂਦੇ ਪੀਂਦੇ ਜੀ ਲੱਡੂ ਜਲੇਬੀਆਂ ਗੰਨੇ ਦਾ ਰਸ ਸਭ ਕੁਝ ਮਿਲਦਾ ਹੈ ਹੁਣ ਮੇਲੇ ਆ ਜਿਹੜੇ ਬਹੁਤ ਅੱਗੇ ਟੱਪ ਗਏ ਨੇ ਹੁਣ ਮੇਲਿਆਂ ਦੇ ਵਿੱਚ ਘੋੜੀਆਂ ਟਰੈਕਟਰ ਉਹ ਤਰ੍ਹਾਂ ਤਰ੍ਹਾਂ ਦੀਆਂ ਮਸ਼ੀਨਰੀਆਂ ਆਉਂਦੀਆਂ ਨੇ ਜਿਹੜੀਆਂ ਵੇਖ ਕੇ ਹਰ ਇੱਕ ਬੰਦਾ ਹੱਕਾ ਬੱਕਾ ਰਹਿ ਜਾਂਦਾ ਇਹ ਮੇਲਿਆਂ ਦੇ ਵਿੱਚ ਅੱਗੇ ਨਾਲੋਂ ਬਹੁਤ ਜ਼ਿਆਦਾ ਤਜਰਬੇਕਾਰ ਬੰਦੇ ਆ ਗਏ ਨਾ ਤਾਂ ਮੇਲਿਆਂ ਨੂੰ ਬਹੁਤ ਉੱਚਾ ਲੈ ਗਏ ਨਾ ਮੇਲਿਆਂ ਦੇ ਵਿੱਚ ਹੁਣ ਤਾਂ ਰਹਿ ਗਿਆ ਹੈ ਬਸ ਖਾਣਾ ਪੀਣਾ ਅਤੇ ਪੈਸਿਆਂ ਦੀ ਬਰਬਾਦੀ ਅੱਗੇ ਮੇਲ ਮਿਲਾਪ ਅਤੇ ਵਧੀਆ ਮੇਲ ਜੋਲ ਹੋ ਕੇ ਤੁਰ ਕੇ ਜਾਂਦੇ ਸੀ ਤੁਰ ਕੇ ਆਉਂਦੇ ਸੀ ਹੁਣ ਏ ਸੀ ਗੱਡੀਆਂ ਦੇ ਵਿੱਚ ਜਾਂਦੇ ਨਾ ਅਤੇ ਏ ਸੀ ਗੱਡੀਆਂ ਦੇ ਵਿੱਚ ਹੀ ਵਾਪਿਸ ਆ ਜਾਂਦੇ ਨੇ ਕਿਸੇ ਨੂੰ ਕੋਈ ਪਤਾ ਨਹੀਂ ਲੱਗਦਾ ਜਦੋਂ ਤੱਕ ਕੋਈ ਨਾ ਦੱਸੀਏ ਕਿ ਇਹ ਫਲਾਣੇ ਥਾਂ 'ਤੇ ਫਲਾਣੀ ਚੀਜ਼ ਖੜੀ ਹੈ ਇਹ ਫਲਾਣੇ ਚੀਜ਼ 'ਤੇ ਫਲਾਣਾ ਮੇਲਾ ਲੱਗਿਆ ਫਲਾਣੇ ਥਾਂ 'ਤੇ ਘੋੜੀਆਂ ਹਨ ਫਲਾਣੇ ਥਾਂ ਟਰੈਕਟਰ ਨਾ ਹੁਣ ਤਾਂ ਬਸ ਲੋਕ ਮੇਲਿਆਂ ਦੇ ਵਿੱਚ ਐਂਈ ਉਲਝ ਜਾਂਦੇ ਨੇ ਕਿਸੇ ਦਾ ਤਾਂ ਨਹਾਉਣ ਵੇਲਾ ਵੀ ਨਹੀਂ ਹੁੰਦਾ ਜਾਂਦੇ ਆ ਅਤੇ ਉਸ ਤਰ੍ਹਾਂ ਹੀ ਵਾਪਿਸ ਮੁੜ ਆਉਂਦੇ ਨੇ ਸੋ ਮੇਲਿਆਂ ਦੀ ਮਹੱਤਤਾ ਦੇ ਬਾਰੇ ਤਾਂ ਸਾਨੂੰ ਗੁਰੂ ਘਰਾਂ ਦੇ ਵਿੱਚ ਜਾ ਕੇ ਜਦੋਂ ਇਸਨਾਨ ਕਰਕੇ ਬੈਠਦੇ ਹਾਂ ਉਦੋਂ ਪਤਾ ਲੱਗਦਾ ਜਦੋਂ ਭਾਈ ਜੀ ਦੱਸਦਾ ਕਿ ਭਾਈ ਮੇਲਾ ਇਸ ਕਰਕੇ ਲਗਾਇਆ ਜਾਂਦਾ ਇਹ ਮੇਲਾ ਇੱਥੇ ਗੁਰੂ ਕੀ ਢਾਵ ਹੈ ਜਿੱਥੇ ਤੰਬੂ ਸਾਹਿਬ ਹੈ ਮੁਕਤਸਰ ਤੋਂ ਕੋਈ ਕਿਲੋ ਕੁ ਮੀਟਰ ਦੂਰ ਉੱਥੇ ਸਿੰਘਾਂ ਨੂੰ ਘੇਰਾ ਪੈ ਗਿਆ ਸੀ ਦੋ ਚਾਰ ਸਿੰਘ ਸੀ ਅਤੇ ਉਹਨਾਂ ਨੇ ਇਸਨਾਨ ਕਰਨ ਤੋਂ ਬਾਅਦ ਆਪਣੇ ਲੀੜੇ ਕੱਪੜੇ ਕਛਹਿਰੇ ਲਾ ਕੇ ਝਾੜੀਆਂ 'ਤੇ ਟੰਗਤੇ ਅਤੇ ਇਹ ਜੀ ਮੇਲੇ ਦੀ ਉੱਥੋਂ ਹੀ ਬਹੁਤ ਵੱਡੀ ਇੱਕ ਮਿਸਾਲਤ ਹੈ ਕਿ ਦੁਸ਼ਮਣ ਨੂੰ ਐਂ ਪਤਾ ਲੱਗਿਆ ਵੀ ਦੁਸ਼ ਕਛਹਿਰਾਇਆਂ ਨੂੰ ਵੇਖ ਕੇ ਕਿ ਇੱਥੇ ਫੌਜ ਬਹੁਤ ਤਕੜੀ ਹੈ ਸਿੱਖਾਂ ਦੀ ਟੈਂਟ ਲਾਈ ਬੈਠੇ ਨੇ ਜਦੋਂ ਉੱਥੇ ਜਾ ਕੇ ਵੇਖਿਆ ਤਾਂ ਉੱਥੇ ਕੁਛ ਵੀ ਨਹੀਂ ਸੀ ਸੋ ਇਹ ਇੱਕ ਬਹੁਤ ਵੱਡੀ ਤਜਰਬੇ ਅਤੇ ਮੇਲਿਆਂ ਦਾ ਹੋਂਦ ਵਿੱਚ ਆਈ ਹੈ